ਹਾਂ ਅਗਰ ਆਪਾਂ ਕਿੱਥੇ ਬਾਹਰ ਜਾਂਦੇ ਹਾਂ ਜਾਂ ਯਾਤਰਾ ਕਰਦੇ ਹਾਂ ਤਾਂ ਇਹ ਸਿੰਪਲ ਇਹੀ ਗੱਲ ਹੁੰਦੀ ਹੈ ਕਿ ਆਪਾਂ ਕੁਛ ਨਵਾਂ ਵੇਖਣ ਜਾਂਦੇ ਹਾਂ ਇੱਕ ਤਾਂ ਮੈਨੂੰ ਘੁੰਮਣ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ ਅਤੇ ਮੈਂ ਨਵੇਂ ਨਵੇਂ ਜਗ੍ਹਾ 'ਤੇ ਜਾਂਦੀ ਹਾਂ ਖ਼ਾਸ ਤੌਰ 'ਤੇ ਯਾਤਰਾ ਕਰਦੀ ਹਾਂ ਮੈਂ ਦੇਖਣਾ ਚਾਹੁੰਦੀ ਹਾਂ ਕਿ ਮੇਰੇ ਵਿੱਚ ਕਿੰਨੀ ਹਿੰਮਤ ਹੈਗੀ ਹੈ ਜੋ ਮੈਂ ਹਾਂ ਕਿਸੇ ਵੀ ਯਾਤਰਾ 'ਤੇ ਜਾਂਦੇ ਟਾਈਮ ਮੇਰੇ 'ਚ ਕਿੰਨੀ ਹਿੰਮਤ ਹੈਗੀ ਹੈ ਕਿ ਮੈਂ ਉੱਥੇ ਜਾ ਸਕਦੀ ਹਾਂ ਅਤੇ ਯਾਤਰਾ ਦਾ ਕੋਈ ਨਵੀਂ ਖੇਡ ਸ਼ੌਕ ਤਾਂ ਨਹੀਂ ਕਿ ਹਾਂ ਬਹੁਤ ਹ ਦਿਲ ਕਰਦਾ ਉੱਥੇ ਜਾ ਕੇ ਆਪਾਂ ਜਦੋਂ ਨਵੇਂ ਨਵੇਂ ਜਗ੍ਹਾ 'ਤੇ ਜਾਂਦੇ ਹਾਂ ਅਤੇ ਸਾਨੂੰ ਬਹੁਤ ਕੁਛ ਵੇਖਣ ਨੂੰ ਮਿਲਦਾ ਹੈ ਜਿਵੇਂ ਕਿ ਉੱਥੇ ਨਵੇਂ ਨਵੇਂ ਖੇਡ ਹੁੰਦੇ ਹਨ ਆਪਾਂ ਅਗਰ ਕਿੱਥੇ ਵੀ ਜਾਂਦੇ ਹਾਂ ਉੱਥੇ ਅਲੱਗ ਅਲੱਗ ਤਰ੍ਹਾਂ ਦੀ ਗੇਮ ਹੁੰਦੀਆਂ ਹੈ ਹ ਖੇਡ ਹੁੰਦੀਆਂ ਅਤੇ ਆਪਾਂ ਉਸ ਖੇਡਾਂ ਵਿੱਚ ਹਿੱਸਾ ਵੀ ਲੈ ਸਕਦੇ ਹਾਂ ਅਤੇ ਉਹ ਸਾਨੂੰ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲ ਜਾਂਦੀ ਹੈ ਯਾਤਰਾ ਦਾ ਅਰਥ ਹੁੰਦਾ ਹੈ ਕਿ ਆਪਾਂ ਸਾਡੇ ਵਿੱਚ ਕਿੰਨੀ ਕੁ ਹਿੰਮਤ ਹੈਗੀ ਹੈ ਕਿ ਆਪਾਂ ਉਸ ਚੀਜ਼ ਨੂੰ ਯਾਤਰਾ ਕਰ ਸਕਦੇ ਹਾਂ ਕਿ ਨਹੀਂ ਸਾਡੇ ਵਿੱਚ ਕਿੰਨੀ ਇਹ ਪਾਵਰ ਹੈਗੀ ਹੈ ਇੱਕ ਤਰ੍ਹਾਂ ਦੀ ਅਤੇ ਮੈਨੂੰ ਜਿਵੇਂ ਕਿ ਘੁੰਮਣ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈਗਾ ਅਤੇ ਮੈਂ ਜ਼ਿਆਦਾਤਰ ਹ ਹਿਸਟੋਰੀਕਲ ਪਲੇਸ ਜਿਵੇਂ ਕਿ ਮੈਂ ਗਈ ਹੋਈ ਹਾਂ ਕਿ ਮੈਂ ਇੱਥੇ ਮਾਤਾ ਵਗੈਰਾ ਤੇ ਬਹੁਤ ਜ਼ਿਆਦਾ ਘੁੰਮੀ ਹੋਈ ਹਾਂ ਮੈਂ ਉੱਥੇ ਪੈਦਲ ਯਾਤਰਾ ਜਾ ਚੁੱਕੀ ਹਾਂ ਪੈਦਲ ਮੈਂ ਬਹੁਤ ਵਾਰ ਗਈ ਹਾਂ ਕਿਉਂਕਿ ਇੱਕ ਤਾਂ ਇੰਨਾ ਮਨੋਰੰਜਨ ਵਗੈਰਾ ਸਭ ਚੀਜ਼ਾਂ ਹੁੰਦੀਆਂ ਇੰਨੀ ਖੁਸ਼ੀ ਮਿਲਦੀ ਹੈ ਸਾਰੇ ਇਹ ਪਰਿਵਾਰ ਇਕੱਠੇ ਹੋ ਜਾਂਦੇ ਹਨ ਅਤੇ ਯਾਤਰਾ ਇਕੱਠੇ ਕਰਦੇ ਹਨ ਇੱਕ ਤਾਂ ਪਰਿਵਾਰ ਦਾ ਮੇਲ ਮਿਲਾਪ ਹੋ ਜਾਂਦਾ ਹੈ ਅਤੇ ਹੋਰ ਵੀ ਕਈ ਨਵੀਆਂ ਨਵੀਆਂ ਚੀਜ਼ਾਂ ਜੋ ਸਾਨੂੰ ਦੇਖਣ ਨੂੰ ਦਿਖ ਜਾਂਦੀਆਂ ਹਨ